ਹਾਂਜੀ ਬ੍ਰਹਿਮੰਡ ਦੇ ਅਲੱਗ ਅਲੱਗ ਜਿਹੜੇ ਹੈਗੇ ਹੈ ਗ੍ਰਹਿ ਹੈਗੇ ਹੈ ਜਿਵੇਂ ਮੰਗਲ ਗ੍ਰਹਿ ਚੰਦ ਹੈ ਬ੍ਰਹਿਸਪਤੀ ਗ੍ਰਹਿ ਇਹਨਾਂ 'ਤੇ ਰਹਿਣ ਦਾ ਪ੍ਰਬੰਧ ਹੈਗਾ ਹੈ ਕਿਉਂਕਿ ਜਿਹੜਾ ਜਨ ਜੀਵਨ ਹੈ ਉਹ ਹਵਾ ਆਕਸੀਜ਼ਨ ਦੀ ਵੈਲਯੂ ਉੱਥੇ ਬਹੁਤ ਜ਼ਿਆਦਾ ਹੈਗੀ ਹੈ ਰਹਿ ਸਕਦੇ ਹੈ ਵਿਗਿਆਨੀਆਂ ਨੇ ਖੋਜ ਕਰੀ ਸੀ